ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ 'ਚ ਬਹੁਤ ਜ਼ਿਆਦਾ ਫ਼ਰਕ ਹੈ ਜਿੱਦਾਂ ਕਿ ਪਹਿਲਾਂ ਪੁਰਾਣੇ ਗੀਤ ਹੁੰਦੇ ਸੀਗੇ ਹੈ ਨਾ ਉਹ ਬਹੁਤ ਜ਼ਿਆਦਾ ਸਾਫ਼ ਸੁਥਰੇ ਅਤੇ ਵਧੀਆ ਤਰੀਕੇ ਦੇ ਨਾਲ ਗਾਏ ਹੁੰਦੇ ਸੀਗੇ ਅਤੇ ਹੈ ਨਾ ਅਸੀਂ ਫ਼ੈਮਿਲੀ ਦੇ ਵਿੱਚ ਬੈਠ ਕੇ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਸੁਣ ਸਕਦੇ ਸੀ ਕੋਈ ਬੱਚਾ ਕੀ ਬਜ਼ੁਰਗ ਹਰੇਕ ਕੋਈ ਉਨ੍ਹਾਂ ਗਾਣੇ ਨੂੰ ਸੁਣ ਸਕਦਾ ਸੀਗਾ ਹੈ ਨਾ ਸਾਰੇ ਸੁਣਦੇ ਸੀਗੇ ਉਹਨਾਂ ਨੂੰ ਪਰ ਅੱਜ ਕੱਲ੍ਹ ਦੇ ਗੀਤ ਇੱਦਾਂ ਦੇ ਹੈ ਮੈਂ ਮਾਰ ਦੂ ਕੋਈ ਕੁਛ ਕਰ ਦੂ ਜੱਟ ਆ ਗਿਆ ਫ਼ਲਾਣਾ ਹੋ ਗਿਆ ਤੈਨੂੰ ਵਿਆਹ ਕੇ ਲੈ ਜਾਣਾ ਇੱਦਾਂ ਦੇ ਗੀਤ ਜਦਕਿ ਇੱਦਾਂ ਦੇ ਗੀਤ ਨਾ ਤਾਂ ਬੱਚੇ ਸੁਣ ਸਕਦੇ ਆ ਨਾ ਬਜ਼ੁਰਗ ਸੁਣ ਸਕਦੇ ਆ ਨਾ ਉਹ ਸੁਣਨ ਨੂੰ ਗੀਤ ਵਧੀਆ ਲੱਗਦੇ ਆ ਅਤੇ ਹਾਂ ਮੈਨੂੰ ਪੁਰਾਣੇ ਗੀਤਾਂ ਦੇ ਵਿੱਚੋਂ ਇੱਕ ਗੀਤ ਬਹੁਤ ਜ਼ਿਆਦਾ ਪਸੰਦ ਆ ਜਿੱਦਾਂ ਕਿ ਸੁਰਿੰਦਰ ਕੌਰ ਦਾ ਗਾਇਆ ਹੋਇਆ ਗੀਤ ਆ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਓ ਰੱਬਾ ਵੇ ਸਾਨੂੰ ਤੁਰਨਾ ਪਿਆ